ਕਾਨੂੰਨੀ ਦਸਤਾਵੇਜ਼ ਜੋ ਕਿ ਕਚਹਿਰੀਆਂ ਵਿੱਚ ਮਜਿਸਟਰੇਟ ਡੀਸੀ ਦਫਤਰ ਅਤੇ ਸੈਸ਼ਨ ਜੱਜ ਤੋਂ ਅਪਲਾਈ ਹੁੰਦੇ ਹਨ ਇਹ ਦਸਤਾਵੇਜ਼ ਲੈਣ ਲਈ ਫਾਰਮ ਭਰ ਕੇ ਅਪਲਾਈ ਕਰਨਾ ਪੈਂਦਾ ਹੈ ਜੋ ਕਿ ਕੁਝ ਸਮੇਂ ਬਾਅਦ ਉਹਨਾਂ ਦੀ ਨਕਲ ਇਨਸਾਨ ਨੂੰ ਵਕੀਲ ਨੂੰ ਮਿਲ ਜਾਂਦੀ ਹੈ ਜੋ ਕਿ ਕੁਝ ਦਸਤਾਵੇਜ਼ ਕੁਛ ਦਫ ਮਹਿਕਮਿਆਂ ਦੇ ਲੈਣ ਲੈਣੇ ਔਖੇ ਵੀ ਹਨ ਜੋ ਆਰ ਟੀ ਆਈ ਪਾ ਕੇ ਉਸਦਾ ਮਹਿਕਮੇ ਤੋਂ ਪੁੱਛਿਆ ਜਾਂਦਾ ਹੈ ਅਤੇ ਉਸ ਉਹ ਦਫਤਰ ਉਹ ਮਹਿਕਮੇ ਆਪਦੀ ਗੱਡੀਆਂ ਬਾਰੇ ਆਪਦੇ ਆਪਦੀਆਂ ਤਨਖਾਹਾਂ ਬਾਰੇ ਦੱਸਣ ਤੋਂ ਗੁਰਹੇਜ਼ ਕਰਦੇ ਹਨ ਅਤੇ ਕਾਫੀ ਸਮਾਂ ਲੰਘਾ ਦਿੰਦੇ ਹਨ ਪਰ ਹੁਣ ਦੇਸ਼ ਵਿੱਚ ਆਰ ਟੀ ਆਈ ਕਾਨੂੰਨ ਬਣਿਆ ਕਰਕੇ ਇਸ ਕਾਨੂੰਨ ਰਾਹੀਂ ਇਹ ਲੈਣ ਦੇਣੇ ਪੈਂਦੇ ਹਨ ਅਤੇ ਲੈਣੇ ਸੌਖੇ ਹੋ ਗਏ ਹਨ ਪਰ ਕੁਛ ਦਿਨ ਸਮਾਂ ਲੱਗਦਾ ਹੈ ਜੋ ਕਿ ਸੈਸ਼ਨ ਜੱਜ ਦੇ ਹੁਣ ਆਨਲਾਈਨ ਹੋਣ ਨਾਲ ਇਹ ਦਸਤਾਵੇਜ਼ ਤਰੀਕਾ ਵਗੈਰਾ ਸਾਰਾ ਕੁਛ ਔਨਲਾਈਨ ਹੋਣ ਕਰਕੇ ਸੌਖਾ ਵੀ ਹੋਇਆ ਹੈ ਜੋ ਕਿ ਔਨਲਾਈਨ ਦੇਖ ਕੇ ਦੱਸ ਦਿੰਦੇ ਹਨ ਕੁਛ ਦਸਤਾਵੇਜ਼ ਸੌਖੇ ਮਿਲ ਜਾਂਦੇ ਹਨ ਕਾਨੂੰਨੀ ਪ੍ਰਕਿਰਿਆ ਵਿੱਚ ਵੀ ਬਹੁਤ ਸੁਧਾਰ ਕੀਤਾ ਗਿਆ ਹੈ ਸਾਡਾ ਦੇਸ਼ ਤਰੱਕੀ ਵੱਲ ਜਾ ਰਿਹਾ ਹੈ ਜਿਸ ਦੇ ਕਾਰਨ ਕਾਨੂੰਨੀ ਦਸਤਾਵੇਜ਼ ਮਿਲ ਲੈਣੇ ਸੌਖੇ ਹਨ ਇਸ ਕਰਕੇ ਪ੍ਰਕਿਰਿਆ ਰਾਹੀਂ ਹਰੇਕ ਦਸਤਾਵੇਜ਼ ਆਪਣੀ ਪ੍ਰਕਿਰਿਆ ਰਾਹੀਂ ਮਿਲਦੇ ਹਨ ਅਤੇ ਫਾਰਮ ਭਰ ਕੇ ਸਰਕਾਰੀ ਟਿਕਟ ਲਾ ਕੇ ਜਿਸ ਆਦਮੀ ਵੱਲੋਂ ਅਪਲਾਈ ਕੀਤੇ ਜਾਂਦੇ ਹਨ ਉਸ ਨੂੰ ਡਾਕ ਰਾਹੀਂ ਜਾਂ ਬਾਈ ਹੈਂਡ ਦਿੱਤੇ ਜਾਂਦੇ ਹਨ